ਹੈਲੋ ਹੈਲੋ ਹਾਂਜੀ ਹਾਂਜੀ ਆ ਰਹੀ ਹੈ ਹਾਂਜੀ ਹਾਂਜੀ ਹਾਂ ਅੱਛਾ ਅੱਛਾ ਅੱਛਾ ਉਹਦੀ ਸ਼ੂਜ਼ ਦੀ ਇੱਕ ਸਾਲ ਦੀ ਗਰੰਟੀ ਹੁੰਦੀ ਹੈ ਪਰ ਕੇਅਰ ਵੀ ਨਾਲ ਕਰਨੀ ਪੈਂਦੀ ਹੈ ਹਾਂਜੀ ਹਾਂਜੀ ਹਾਂਜੀ ਇੱਕ ਸਾਲ ਦੇ ਅੰਦਰ ਅੰਦਰ ਅਗਰ ਖਰਾਬ ਹੋ ਜਾਂਦਾ ਹੈ ਤਾਂ ਉਹਦੀ ਰਿਟਰਨ ਪੋਲਿਸੀ ਹੈ ਅਸੀਂ ਬਿੱਲ ਦੇ ਉੱਪਰ ਹੀ ਲਿਖ ਕੇ ਦੇ ਦਿਆਂਗੇ ਤੁਹਾਨੂੰ ਠੀਕ ਹੈ ਕਿੰਨੀ ਦੇਰ ਹੋ ਗਈ ਤੁਹਾਨੂੰ ਲਿਆ ਨੂੰ ਅੱਛਾ ਅੱਛਾ ਅੱਛਾ ਮੈਨਟੀਨੈਂਸ ਕਰਨੀ ਪੈਂਦੀ ਹੈ ਉਹਨੂੰ ਗਿੱਲੇ ਗੁੱਲੇ ਕਰਨ ਤੋਂ ਬਚਾਉਣਾ ਪੈਂਦਾ ਗਿੱਲੇ ਹੋਕੇ ਆਪਾਂ ਕਈ ਵਾਰ ਪੈਕ ਕਰਕੇ ਆਪਾਂ ਰੱਖ ਦਿੰਦੇ ਹਾਂ ਗਿੱਲੇ ਨੂੰ ਅਤੇ ਫਿਰ ਤਾਂ ਖਰਾਬ ਹੋਣੇ ਹੀ ਹੁੰਦੇ ਆ ਹਾਂ ਹਾਂ ਵਾਸ਼ ਵਾਸ਼ੇਵਲ ਨੇ ਹਾਂਜੀ ਹਾਂਜੀ ਠੀਕ ਹੈ ਹਾਂ ਫਿਰ ਧੁੱਪੇ ਵੀ ਧੁੱਪੇ ਵੀ ਸੁਕਾ ਸਕਦੇ ਹੋ ਹਾਂ ਸਿੰਪਲ ਵੀ ਵਾਸ਼ ਹੈ ਉਹਦਾ ਨਹੀਂ ਖਰਾਬ ਤਾਂ ਨਹੀਂ ਹੁੰਦੇ ਉੱਦਾਂ ਵੀ ਧੋ ਸਕਦੇ ਹੋ ਹਾਂਜੀ ਹਾਂ ਹਾਂ ਹਾਂਜੀ ਏ ਉਹ ਰਿਟਰਨ ਹੋ ਜਾਣਗੇ ਫਿਰ ਤੁਹਾਡੇ ਨਹੀਂ ਉਹਨਾਂ ਨੂੰ ਵਾਪਿਸ ਭੇਜਣਾ ਪਵੇਗਾ ਪਹਿਲਾਂ ਫਿਰ ਉੱਥੋਂ ਬਦਲ ਕੇ ਆ ਜਾਣਗੇ ਫਿਰ ਹਾਂਜੀ ਹਾਂਜੀ ਬਿਲਕੁਲ ਸਾਡੇ ਕੋਲ ਲਿਬਰਟੀ ਦੇ ਵੀ ਨੇ ਐਕਸ਼ਨ ਦੇ ਵੀ ਨੇ ਐਡੀਡਾਸ ਦੇ ਵੀ ਨੇ ਹਾਂ ਹਰ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਹਾਂ ਇਹ ਸਭ ਦੀ ਗਰੰਟੀ ਹੁੰਦੀ ਹੈ ਇਹਨਾਂ ਦੀ ਠੀਕ ਹੈ ਤੁਸੀਂ ਲੈ ਆਉਣਾ ਉਹਨੂੰ ਅਤੇ ਬਿੱਲ ਦੇ ਉੱਪਰ ਲਿਖ ਦਿਆਂਗੇ ਤੁਹਾਡੇ

ਠੀਕ ਹੈ ਠੀਕ ਹੈ ਜੀ ਹਾਂਜੀ